ਪੰਜਾਬ ਦੇ ਸੱਭਿਆਚਾਰ ਵਿੱਚ ਬਹੁਤ ਸਾਰੇ ਤਿਉਹਾਰ ਅਤੇ ਪਰੰਪਰਾਵਾਂ ਹਨ ਜਿਵੇਂ ਪਹਿਰਾਵੇ ਦੀ ਗੱਲ ਕਰੀਏ ਪਹਿਰਾਵੇ ਵਿੱਚ ਆਦਮੀ ਕੁੜਤਾ ਪਜਾਮਾ ਪੈਰਾਂ ਵਿੱਚ ਪੰਜਾਬੀ ਜੁੱਤੀ ਗਲ਼ ਵਿੱਚ ਕੈਂਠਾ ਅਤੇ ਹੱਥ ਵਿੱਚ ਖੁੰਡਾ ਫੜ੍ਹਦੇ ਹਨ ਅਤੇ ਜਨਾਨੀਆਂ ਦੇ ਪਹਿਰਾਵੇ ਦੀ ਗੱਲ ਕਰੀਏ ਜਨਾਨੀਆਂ ਸਲਵਾਰ ਸੂਟ ਪੈਰਾਂ ਵਿੱਚ ਪੰਜਾਬੀ ਜੁੱਤੀ ਅਤੇ ਸਿਰ 'ਤੇ ਫੁਲਕਾਰੀ ਵਾਲ਼ੀ ਚੁੰਨੀ ਲੈਂਦੀਆਂ ਹਨ ਤਿਉਹਾਰਾਂ ਦੀ ਗੱਲ ਕਰੀਏ ਜਿਵੇਂ ਕਿ ਆਪਣੇ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਵਿਸਾਖੀ ਹੋਲਾ ਮਹੱਲਾ ਦੀਵਾਲੀ ਵਿਸਾਖੀ ਨੂੰ ਕਣਕ ਦੀ ਕਟਾਈ ਕੀਤੀ ਜਾਂਦੀ ਹੈ ਅਤੇ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਸਾਜਨਾ ਕੀਤੀ ਸੀ ਦੀਵਾਲੀ ਦੇ ਦਿਨ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਵੰਜਾ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ ਅਤੇ ਉਸ ਦੀ ਖੁਸ਼ੀ ਵਿੱਚ ਸਿੱਖਾਂ ਨੇ ਦੀਪਮਾਲਾ ਕੀਤੀ ਸੀ ਅਤੇ ਪੰਜਾਬ ਵਿੱਚ ਦੀਵਾਲੀ ਇਸ ਕਰਕੇ ਮਨਾਈ ਜਾਂਦੀ ਹੈ ਹੋਲਾ ਮਹੱਲੇ ਨੂੰ ਨਿਹੰਗ ਸਿੰਘ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹਨ